ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਸ਼ਰਮਾ ਸਟੇਸ਼ਨਰੀ ਦੁਕਾਨ ਤੋਂ ਬੋਲ ਰਹੇ ਜੀ ਹਾਂਜੀ ਬੱਚੇ ਦੀ ਬੁੱਕਾਂ ਲੈਣੀਆਂ ਸੀ ਜੀ ਫਿਫਥ ਕਲਾਸ ਮੇ ਆਪਣੇ ਆਦਰਸ਼ ਸਕੂਲ ਸਾਰੇ ਠੀਕ ਐ ਜੀ ਪਹਿਲਾਂ ਤਾਂ ਬੱਚਾ ਆਪਣਾ ਹੈਗਾ ਸੀ ਸਰਕਾਰੀ ਸਕੂਲ ਚ ਇੰਗਲਿਸ਼ ਮੀਡੀਅਮ ਸਕੂਲ ਚ ਲਾਇਆ ਸਰ ਇੰਗਲਿਸ਼ ਵਿਚ ਹੀ ਚਾਹੀਦੇ ਨੇ ਬੁੱਕਾ ਤਾਂ ਹਾਂਜੀ ਬੁਕਸ ਤੋਂ ਬਾਅਦ ਜਿਵੇਂ ਕੋਈ ਕਾਡ ਹੋਏ ਜਾਏ ਆਪਣੀਆਂ ਪੈਨਸ਼ਨ ਹੋਈ ਕਾਪੀਆਂ ਹੋਈਆਂ ਇਨਾਂ ਚ ਆਪਾ ਨੂੰ ਕਾਪੀਆ ਨੇ ਦਰਜਨ ਦੇ ਹਿਸਾਬ ਨਾਲ ਕਿੰਨਾ ਰੇਟ ਦਾ ਫਰਕ ਪੈ ਰਿਹਾ ਕੀ ਕੁਛ ਠੀਕ ਐ ਜੀ ਇਹਦੇ ਤੁਸੀਂ ਠੀਕ ਐ ਜੀ ਠੀਕ ਐ ਜੀ ਠੀਕ ਐ ਜੀ ਤੇ ਸਰ ਆਪਣੇ ਕੋਲੇ ਜਿਵੇਂ ਸਕੂਲ ਸਕੂਲ ਨਾਲ ਬੱਚਿਆਂ ਦੇ ਜਿਵੇਂ ਕਿ ਸਕੂਲ ਦੇ ਵਿੱਚ ਗੇਮਿੰਗ ਕਰਦਾ ਹੈਗਾ ਉਹਦੇ ਵਾਸਤੇ ਉਹਦੇ ਵਾਸਤੇ ਪੁੱਛਣਾ ਕੋਈ ਸਪੋਰਟਸ ਵੀ ਮਿਲ ਸਕਦੀ ਹੈਗੀ ਫਟਬਾਲ ਹੋਈ ਹਾਂਜੀ ਪੰਜਵੀਂ ਦੀ ਕਿਤਾਬ ਆ ਸਬਜੈਕਟ ਵਾਸਤੇ ਸਕੂਲ ਦੇ ਵਿੱਚੋ ਸਾਰਾ ਲਿਖਵਾ ਦੇਣਾ ਕਿ ਚਾਹੇ ਨਾ ਤੁਹਾਨੂੰ ਵਟਸਐਪ ਭੇਜਣਾ ਕਿ ਹਾਂਜੀ ਅੱਛਾ ਠੀਕ ਐ ਜੀ ਠੀਕ ਐ ਸਰ ਥੈਂਕ ਯੂ